ਮੈਂ ਤੁਹਾਡੇ ਸਾਰਿਆਂ ਨਾਲ ਇੱਕ ਬਹੁਤ ਹੀ ਜ਼ਰੂਰੀ ਅਤੇ ਬਹੁਤ ਹੀ ਖੁਸ਼ੀ ਵਾਲੀ ਚੀਜ਼ ਅੱਜ ਸਾਂਝਾ ਕਰਨਾ ਚਾਹੁੰਦਾ ਹਾਂ ਮੈਂ ਕੁਛ ਦਿਨ ਪਹਿਲਾਂ ਹੀ ਆਨਲਾਈਨ ਜਾ ਕੇ ਇੱਕ ਸਮਾਰਟ ਵਾਚ ਦਾ ਆਰਡਰ ਦਿੱਤਾ ਸੀ ਜੋ ਕਿ ਅੱਜ ਮੈਨੂੰ ਮਿਲ ਗਈ ਹੈ ਜੋ ਵੀ ਮੈਂ ਔਨਲਾਈਨ ਜੋ ਵੀ ਦੇਖੀ ਸੀ ਉਹੀ ਚੀਜ਼ ਮੈਨੂੰ ਸੇਮ ਇਸ ਤਰ੍ਹਾਂ ਦੀ ਹੀ ਇਹ ਹੀ ਮੈਨੂੰ ਇਸ ਦੇ ਵਿੱਚ ਮਿਲੀ ਹੈ ਇਸ ਦਾ ਰੰਗ ਇਸ ਦੀ ਜੋ ਬਣਾਈ ਹੈ ਜਿਸ ਤਰ੍ਹਾਂ ਨਾਲ ਜੋ ਵੀ ਮਟੀਰੀਅਲ ਇਸਦੇ ਵਿੱਚ ਯੂਸ ਕੀਤਾ ਗਿਆ ਹੈ ਉਹ ਬਹੁਤ ਹੀ ਵਧੀਆ ਹੈ ਫਿਰ ਇਸ ਤੋਂ ਬਾਅਦ ਦੇਖਿਆ ਜਾਵੇ ਤਾਂ ਜੋ ਇਸਦੀ ਇਸਦਾ ਡਿਜ਼ਾਇਨ ਹੈ ਉਹ ਬਹੁਤ ਹੀ ਖੂਬਸੂਰਤ ਹੈ ਜੋ ਇਸ ਦੇ ਵਿੱਚ ਦੇਖੀਏ ਕਿ ਜੋ ਵੀ ਇਹ ਸਮਾਰਟ ਜਿਵੇਂ ਕਿ ਆਪਾਂ ਇਸਨੂੰ ਸਮਾਰਟ ਵਾਚ ਕਹਿ ਰਹੇ ਹਾਂ ਤਾਂ ਇਹ ਦੇਖੀਏ ਕਿ ਜੋ ਆਪਣਾ ਫੋਨ ਜੋ ਹੈ ਉਹ ਆਪਣੀ ਕਲਾਈ ਦੇ ਉੱਤੇ ਆ ਚੁੱਕਾ ਹੈ ਜੋ ਵੀ ਕੰਮ ਅਸੀਂ ਸਮਾਰਟ ਫੋਨ ਦੇ ਨਾਲ ਕਰਦੇ ਹਾਂ ਉਹ ਆਪਾਂ ਇਸ ਸਮਾਰਟ ਵਾਚ 'ਤੇ ਵੀ ਕਰ ਸਕਦੇ ਹਾਂ ਜੇ ਆਪਾਂ ਕਿਸੇ ਨੂੰ ਫੋਨ ਕਰਨਾ ਹੈ ਜਾਂ ਕਿਸੇ ਦਾ ਫੋਨ ਸੁਣਨਾ ਹੈ ਕੁਛ ਵੀ ਸ਼ੇਅਰ ਕਰਨਾ ਹੈ ਉਹ ਸਭ ਕੁਛ ਹੀ ਆਪਾਂ ਇਸ ਸਮਾਰਟ ਵਾਚ 'ਤੇ ਕਰ ਸਕਦੇ ਹਾਂ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਮੈਂ ਇਹ ਸਮਾਰਟ ਵਾਚ ਔਡਰ ਕੀਤੀ ਅਤੇ ਇਸਨੂੰ ਦੇਖਦੇ ਹੋਏ ਸਮਾਰਟ ਵਾਚ ਦਾ ਇਹ ਵੀ ਇੱਕ ਫ਼ਾਇਦਾ ਹੈ ਕਿ ਮੈਂ ਆਪਣੀ ਸਿਹਤ ਦਾ ਹੁਣ ਕਾਫ਼ੀ ਅੱਛੀ ਤਰ੍ਹਾਂ ਨਾਲ ਖਿਆਲ ਰੱਖ ਸਕਦਾ ਹਾਂ ਹਰ ਟਾਈਮ ਮੈਂ ਕਿੰਨੇ ਕਦਮ ਦਿਨ ਦੇ ਵਿੱਚ ਚੱਲਿਆ ਕਿੰਨੀ ਵਾਰ ਜੋ ਵੀ ਮੈਂ ਖਾਧਾ ਚੰਗੀ ਤਰਾਂ ਖਾਧਾ ਜੋ ਵੀ ਮੈਂ ਰਾਤ ਨੂੰ ਨੀਂਦ ਲਿੱਤੀ ਚੰਗੀ ਤਰ੍ਹਾਂ ਸੁੱਤਾ ਜਾਂ ਨਹੀਂ ਸੁੱਤਾ ਉਹ ਸਭ ਕੁਛ ਮੈਂ ਇਹਦੇ ਵਿੱਚ ਰਿਕਾਰਡ ਕਰ ਸਕਦਾ ਹਾਂ ਫਿਰ ਬਾਅਦ ਦੇ ਵਿੱਚ ਉਸ ਨੂੰ ਦੇਖ ਵੀ ਸਕਦਾ ਹਾਂ ਜੇ ਕਿਸੇ ਤਰ੍ਹਾਂ ਦੀ ਕੋਈ ਕਮੀ ਹੈ ਉਸ ਦੇ ਵਿੱਚ ਤਾਂ ਉਸਨੂੰ ਸਹੀ ਵੀ ਕਰ ਸਕਦਾ ਹਾਂ ਇਸ ਕਰਕੇ ਮੈਨੂੰ ਇਹ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਮੈਂ ਸਮਾਰਟ ਵਾਚ ਖਰੀਦਣ ਦਾ ਜੋ ਮੇਰਾ ਫ਼ੈਸਲਾ ਸੀ ਬਹੁਤ ਹੀ ਸਹੀ ਸਾਬਿਤ ਹੋ ਰਿਹਾ ਹੈ